ਖੇਡਾਂ ਵਿਅਕਤੀ ਲਈ ਮਨੋਰੰਜਨ ਦਾ ਸਾਧਨ ਹਨ ਖੇਡਾਂ ਨਾਲ ਵਿਅਕਤੀ ਮਾਨਸਿਕ ਤਨਾਅ ਤੋਂ ਦੂਰ ਰਹਿੰਦਾ ਹੈ ਖੇਡਾਂ ਨਾਲ ਵਿਅਕਤੀ ਨੂੰ ਰਾਹਤ ਮਿਲਦੀ ਹੈ ਹਰ ਇੱਕ ਵਿਅਕਤੀ ਖੇਡਣਾ ਪਸੰਦ ਕਰਦਾ ਹੈ ਜਦੋਂ ਕੋਈ ਵਿਅਕਤੀ ਵਿਹਲੇ ਟੈਮ ਵਿੱਚ ਹੁੰਦਾ ਹੈ ਤਾਂ ਉਹ ਖੇਡ ਕੇ ਆਪਣਾ ਮਨੋਰੰਜਨ ਕਰ ਲੈਂਦਾ ਹੈ ਖੇਡਾਂ ਖੇਡਣ ਨਾਲ ਤਨਾਅ ਜਿਵੇਂ ਕੋਈ ਵਿਅਕਤੀ ਜਦੋਂ ਗੁੱਸੇ ਵਿੱਚ ਹੁੰਦਾ ਹੈ ਤਾਂ ਉਹ ਆਪਣਾ ਗੁੱਸਾ ਆਪਣੀ ਗੇਮ 'ਤੇ ਉਤਾਰ ਦਿੰਦਾ ਹੈ ਖੇਡਾਂ ਜਦੋਂ ਕੋਈ ਵਿਅਕਤੀ ਆਪਣੀ ਕੋਈ ਗੇਮ ਰੱਖਦਾ ਹੈ ਤਾਂ ਉਹ ਵੱਧ ਤੋਂ ਵੱਧ ਜਦੋਂ ਉਹ ਖੇਡਦਾ ਹੈ ਤਾਂ ਉਸਦਾ ਵੱਧ ਤੋਂ ਵੱਧ ਟਾਈਮ ਉਸਦੀ ਗੇਮ ਵੱਲ ਜਾਂਦਾ ਹੈ ਉਸਦਾ ਧਿਆਨ ਵੀ ਉਸਦੀ ਗੇਮ ਵੱਲ ਜਾਂਦਾ ਹੈ ਇਸ ਤਰ੍ਹਾਂ ਵਿਅਕਤੀ ਮਾਨਸਿਕ ਤਨਾਅ ਤੋਂ ਦੂਰ ਰਹਿੰਦਾ ਹੈ ਖੇਡਾਂ ਖੇਡਣ ਨਾਲ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਇਸ ਤਰ੍ਹਾਂ ਖੇਡਾਂ ਸਮ ਵਿਅਕਤੀ ਦੇ ਲਈ ਮਨੋਰੰਜਨ ਦਾ ਕੰਮ ਕਰਦੀਆਂ ਹਨ ਹਰੇਕ ਵਿਅਕਤੀ ਖੇਡਾਂ ਖੇਡਣਾ ਪਸੰਦ ਕਰਦਾ ਹੈ ਜਦੋਂ ਕੋਈ ਛੋਟਾ ਬੱਚਾ ਹੁੰਦਾ ਹੈ ਤਾਂ ਉਹ ਵੀ ਖੇਡਣਾ ਸ਼ੁਰੂ ਕਰ ਦਿੰਦਾ ਹੈ ਖੇਡਾਂ ਸਾਡੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਇਸ ਲਈ ਹਰ ਇੱਕ ਵਿਅਕਤੀ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਜ਼ਿਆਦਾਤਰ ਲੋਕ ਫਿਰੀ ਟੈਮ ਵਿੱਚ ਖੇਡਾਂ ਖੇਡਦੇ ਹਨ ਪਰ ਜਿਵੇਂ ਕੋਈ ਸਟੂਡੈਂਟ ਹੁੰਦਾ ਹੈ ਉਸਨੇ ਆਪਣੀ ਗੇਮ ਰੱਖੀ ਹੁੰਦੀ ਹੈ ਤਾਂ ਉਹ ਆਪਣੀ ਗੇਮ ਜ਼ਰੂਰ ਖੇਡਦਾ ਹੈ ਇਸ ਨਾਲ ਉਸਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਸ ਦੀ ਸਰੀਰ ਨੂੰ ਤੰਦਰੁਸਤੀ ਵੀ ਮਿਲਦੀ ਹੈ ਅਤੇ ਉਹ ਮਾਨਸਿਕ ਤਨਾਅ ਤੋਂ ਵੀ ਦੂਰ ਰਹਿੰਦਾ ਹੈ